ਪੰਜਾਬੀ ਭਾਸ਼ਾ ਵਿੱਚ ਕੁਝ ਮੁਹਾਵਰੇ ਇੰਝ ਇੱਦਾਂ ਹਨ ਕਿ ਜਿਵੇਂ ਕਿ ਉਖਲੀ 'ਚ ਸਿਰ ਦੇਣਾ ਕਿਸੇ ਦੀ ਗੱਲ 'ਚ ਟੰਗ ਅੜਾਉਣਾ ਸਾਨੂੰ ਕਿਸੇ ਦੀ ਗੱਲ 'ਚ ਟੰਗ ਚਾਹੀਦੀ ਆ ਬੈਲ ਦੂਜਾ ਆ ਬੈਲ ਮੁਝੇ ਮਾਰ ਸਾਨੂੰ ਕਿਸੇ ਦੀ ਗੱਲ ਵਿੱਚ ਟੰਗ ਨਹੀਂ ਨਹੀਂ ਅੜਾਉਣੀ ਚਾਹੀਦੀ ਅਤੇ ਤੀਜਾ ਲਾਲ ਪੀਲਾ ਹੋ ਜਾਣਾ ਕਿਸੇ ਦੀ ਗੱਲ 'ਤੇ ਕਹਿਣ ਨਾਲ ਕਿਸੇ ਨੂੰ ਲਾਲ ਪੀਲਾ ਨਹੀਂ ਹੋਣਾ ਚਾਹੀਦਾ ਅਕਾਲ ਚਲਾਣਾ ਕਰ ਜਾਣਾ ਮਤਲਬ ਕਿ ਕਿਸੇ ਦੀ ਮੌਤ ਹੋ ਜਾਣਾ